ਗਾਉਣਾ ਮੈਨੂੰ ਬਹੁਤ ਪਸੰਦ ਹੈ ਕਿ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਬਾਥਰੂਮ ਸਿੰਗਰ ਮੈਂ ਬਾਥਰੂਮ 'ਚ ਹੀ ਗਾਉਂਦਾ ਰਹਿੰਦਾ ਸੀ ਹੌਲੀ ਹੌਲੀ ਘਰਦਿਆਂ ਨੇ ਸੁਣਿਆ ਵੀ ਬਾਥਰੂਮ ਸਿੰਗਰ ਨਹੀਂ ਬਾਹਰਲਾ ਸਿੰਗਰ ਬਣ ਕਹਿੰਦੇ ਤੂੰ ਅੰਦਰ ਬੈਠਾ ਗੁਣ ਗੁਣਾਉਂਦਾ ਰਹਿੰਦਾ ਸਾਨੂੰ ਵੀ ਸੁਣਾ ਹੌਲੀ ਹੌਲੀ ਸ਼ੌਂਕ ਤਾਂ ਸੀਗਾ ਹੀ ਗਾਣੇ ਸੁਣਨ ਦਾ ਸੁਣ ਸੁਣ ਕੇ ਗਾਉਣ ਵੀ ਲੱਗ ਗਿਆ ਮੈਂ ਸਕੂਲ ਦੇ ਵਿੱਚ ਇੱਕ ਗਾਇਆ ਸੀ ਮੈਂ ਗਾਣਾ ਸਕੂਲ ਦੇ ਵਿੱਚ ਪਹਿਲਾ ਗਾਣਾ ਗਾਇਆ ਸੀ ਮੈਂ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ

ਉਦੋਂ ਬਾਅਦ ਦੋਸਤਾਂ ਦੇ ਵਿੱਚ ਜਦੋਂ ਵੀ ਦੋਸਤਾਂ ਨੂੰ ਪਤਾ ਲੱਗਿਆ ਵੀ ਇਹ ਗਾਉਂਦਾ ਬਹੁਤ ਸੋਹਣਾ ਵਧੀਆ ਤਾਂ ਦੋਸਤ ਵੀ ਕਹਿੰਦੇ ਸੁਣਾਓ ਫਿਰ ਦੋਸਤਾਂ ਦੇ ਵਿੱਚ ਜਦੋਂ ਮਹਿਫਲ ਲੱਗਦੀ ਹੈ ਤਾਂ ਫਿਰ ਗਾਣੇ ਆਪਣੇ ਆਪ ਹੀ ਅੰਦਰੋਂ ਆਉਂਦੇ ਨੇ ਲਖਵਿੰਦਰ ਵਡਾਲੀ ਜੀ ਦਾ ਗਾਣਾ ਬਹੁਤ ਸੋਹਣਾ ਲੱਗਦਾ ਮੈਨੂੰ ਚੂਰੀ ਗਾਣਾ ਉਹਨਾਂ ਦਾ ਬਹੁਤ ਵਧੀਆ ਅਤੇ ਗਾਣੇ ਦਾ ਬਸ ਸੁਣੀ ਚੱਲੋ ਅਤੇ ਗਾਈ ਚੱਲੋ ਕਿਉਂਕਿ ਜਿਹੜਾ ਬੰਦਾ ਸੁਣ ਸਕਦਾ ਗਾ ਵੀ ਉਹੀ ਸਕਦਾ ਜਿਹਨੇ ਸੁਣਿਆ ਹੀ ਨਹੀਂ ਉਹ ਗਾਊਗਾ ਕੀ ਸਭ ਤੋਂ ਪਹਿਲਾਂ ਸੁਣਨਾ ਜ਼ਰੂਰੀ ਹੈ ਮੈਂ ਸੁਣਦਾ ਤਾਂ ਮੈਂ ਗਾਉਨਾ ਜਿਹੜੇ ਗਾਣੇ ਮੈਨੂੰ ਚੰਗੇ ਲੱਗਦਾ ਉਹ ਮੈਂ ਲਿਖ ਲੈਂਦਾ

ਗਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਐਨਰਜੀ ਅ ਐਨਰਜੀ ਰਿਲੀਜ਼ ਹੁੰਦੀ ਆ ਔਰ ਸ਼ਾਂਤ ਹੁੰਦਾ ਮਨ ਗਾ ਕੇ